ਮੇਰਾ ਪਰਿਵਾਰ ਬਹੁਤ ਵੱਡਾ ਹੈ ਅਤੇ ਅਸੀਂ ਅੱਜ ਵੀ ਸਾਰੇ ਜਣੇ ਰਲ਼ ਮਿਲ਼ ਕੇ ਇੱਕੋ ਘਰ ਵਿੱਚ ਰਹਿੰਦੇ ਹਾਂ ਅਤੇ ਸਾਡੀ ਰੋਟੀ ਵੀ ਅਜੇ ਇੱਕੋ ਘਰ ਵਿੱਚ ਇੱਕੋ ਚੁੱਲ੍ਹੇ 'ਤੇ ਪੱਕਦੀ ਹੈ ਅਤੇ ਅਸੀਂ ਸਾਰੇ ਰਲ਼ ਮਿਲ ਕੇ ਰਹਿੰਦੇ ਹਾਂ ਦਾਦਾ ਦਾਦੀ ਚਾਚੇ ਮੇਰੇ ਮਾਂ ਬਾਪ ਸਾਰੇ ਇੱਕ ਦੂਜੇ ਨਾਲ ਐਨ ਮਿਲ ਜੁਲ ਕੇ ਰਹਿੰਦੇ ਹੈ ਅਤੇ ਬਹੁਤ ਵਧੀਆ ਸਾਡਾ ਟਾਈਮ ਕੱਟ ਰਿਹਾ ਅਤੇ ਜਿਹੜੇ ਮੇਰੇ ਯਾਰ ਦੋਸਤ ਆ ਉਹ ਵੀ ਬਹੁਤ ਵਧੀਆ ਨੇ ਅਤੇ ਬਿਲਕੁਲ ਹਾਸੀ ਮਜ਼ਾਕ ਵਾਲੇ ਇਕਦਮ ਖੁਸ਼ ਰਹਿਣ ਵਾਲੇ ਅਤੇ ਇਕ ਦੂਜੇ ਨਾਲ ਇੱਕ ਦੂਜੇ ਨੂੰ ਮੋਟੀਵੇਸ਼ਨ ਕਰਨ ਵਾਲੇ ਸਾਰੇ ਯਾਰ ਦੋਸਤ ਬਹੁਤ ਵਧੀਆ ਨੇ ਅਤੇ ਹਰ ਫੀਲਡ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਹੈਲਪ ਹੋਵੇ ਕੁਛ ਹੋਵੇ ਤਾਂ ਮੇਰੀ ਫੈਮਲੀ ਵੀ ਮੈਨੂੰ ਬਹੁਤ ਸੁਪੋਰਟ ਕਰਦੀ ਹੈ ਅਤੇ ਯਾਰ ਦੋਸਤ ਵੀ ਅਤੇ ਬਹੁਤ ਸਾਥ ਦਿੰਦੇ ਨੇ ਅਤੇ ਅੱਗੇ ਵਧਣ ਲਈ ਘਰਦੇ ਤਾਂ ਪ੍ਰੇਰਿਤ ਕਰਦੇ ਹੀ ਨੇ ਅਤੇ ਯਾਰ ਦੋਸਤ ਵੀ ਕਹਿੰਦੇ ਨੇ ਕਿ ਪੜ੍ਹ ਲਿਖ ਕੇ ਆਪਾਂ ਕੁੱਝ ਬਣਨਾ ਹੈ ਅਤੇ ਆਪਣੇ ਮਾਂ ਪਿਓ ਮਾਂ ਬਾਪ ਆਪਣੇ ਪਰਿਵਾਰ ਦਾ ਨਾਮ ਜ਼ਰੂਰ ਰੌਸ਼ਨ ਕਰਨਾ ਹੈ